ਆਧੁਨਿਕ ਸੰਸਾਰ ਵਿੱਚ ਇਸ ਖੇਤਰ ਦੇ ਲੋਕ ਆਪਣੇ ਧਰਮ ਸਿੱਖ ਧਰਮ ਨਾਲ਼ ਇਸ ਕਰਕੇ ਜੁੜੇ ਹਨ ਕਿਉਂਕਿ ਪੂਰੇ ਦਸਾਂ ਗੁਰੂਆਂ ਦੀ ਸੋਚ ਜੋ ਉਹਨਾਂ ਨੇ ਸਾਨੂੰ ਦੱਸਿਆ ਕਿਵੇਂ ਦੁਨੀਆਂ ਵਿੱਚ ਲੋਕਾਂ ਦਾ ਭਲਾ ਕਰਨਾ ਲੋਕਾਂ ਦੀ ਸੇਵਾ ਕਰਨਾ ਅਤੇ ਕਿਸੇ ਦਾ ਦੁੱਖ ਨਾ ਦੇਖਣਾ ਆਪਣੇ ਆਪਣਾ ਖੁਸ਼ੀ ਦੂਜੇ ਨਾਲ਼ ਸਾਂਝੀ ਕਰਨੀ ਅਤੇ ਦੂਸਰੇ ਦਾ ਦੁੱਖ ਆਪਣੇ ਨਾਲ਼ ਵੰਡਾਉਣਾ ਅਤੇ ਸਾਰਾ ਇਹੀ ਕੁਝ ਸਿੱਖ ਧਰਮ ਨਾਲ਼ ਜੁੜਿਆ ਹੋਣ ਕਾਰਨ ਲੋਕ ਇਸ ਨਾਲ਼ ਬਹੁਤ ਕੁਝ ਇਸ ਤੋਂ ਸਿੱਖਦੇ ਹਨ ਅਤੇ ਦਸਾਂ ਗੁਣੂਆ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਕਰਕੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਕੁਝ ਸਭ ਮਾਨਤਾ ਦਿੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਸਭ ਕੁਝ ਹੈ ਅਤੇ ਇਸ ਦਾ ਮੇਨ ਗੁਰੂ ਗੁਰਦੁਆਰਿਆਂ ਵਿੱਚ ਲੋਕਾਂ ਦੀ ਭਲਾਈ ਕਾਰਨ ਲੋਕਾਂ ਦੀ ਲੰਗਰ ਦੀ ਸੇਵਾ ਚੌਵੀ ਘੰਟੇ ਪ੍ਰਚਲਿਤ ਰਹਿੰਦੀ ਹੈ